ਹੈਲੋ ਹਾਂਜੀ ਮੈਂ ਟਰੈਫਿਕ ਪੁਲਿਸ ਮੁਕਤਸਰ ਤੋਂ ਬੋਲਦਾ ਪਿਆ ਮੈਂ ਥੋਡੀ ਕੀ ਮਦਦ ਕਰ ਸਕਦਾ ਕੀ ਮੈਮ ਤੁਸੀਂ ਦੱਸ ਸਕਦੇ ਹੋ ਗੱਡੀ 'ਚ ਕਿੰਨੇ ਕ ਲੋਕ ਬੈਠੇ ਸੀਗੇ ਮੁੰਡੇ ਜਵਾਨ ਮੁੰਡੇ ਸੀਗੇ ਜਾਂ ਕੋਈ ਕੁੜੀ ਵਗੈਰਾ ਡਰਾਈਵ ਕਰ ਰਹੀ ਸੀਗੀ ਜਾਂ ਕੋਈ ਬੰਦਾ ਅੰਡਰ ਏਜ ਤਾਂ ਨਹੀਂ ਲੱਗਦਾ ਕਿਸੇ ਤੁਹਾਨੂੰ ਜੋ ਚਲਾ ਰਿਹਾ ਸੀਗਾ ਜੋ ਘੱਟ ਉਮਰ ਦਾ ਅਠਾਰਾਂ ਸਾਲ ਤੋਂ ਘੱਟ ਉਮਰ ਦੀ ਹੋਵੇ ਮੈਮ ਤੁਸੀਂ ਮੈਨੂੰ ਦੱਸ ਸਕਦੇ ਹੈਗੇ ਹੋ ਕਿ ਤੁਹਾਡੇ ਆਸ ਪਾਸ ਕੋਈ ਤੁਹਾਨੂੰ ਪਿੱਲਰ ਦਿਖ ਰਿਹਾ ਖੰਬਾ ਲਾਈਟ ਵਾਲਾ ਜਿਹਦੇ ਤੇ ਤੁਹਾਨੂੰ ਨੰਬਰ ਲਿਖਿਆ ਹੋਵੇ ਆਪਾਂ ਜਾਣ ਸਕੀਏ ਕਿ ਤੁਸੀਂ ਇਸ ਟਾਈਮ ਕਿੱਥੇ ਹੈਗਾ ਤੁਸੀਂ ਆਪਾਂ ਟਰੈ ਉਹਨਾਂ ਨੂੰ ਪਤਾ ਕਰਕੇ ਉਹਨਾਂ ਤੇ ਕਾਰਵਾਈ ਕਰ ਸਕੀਏ ਮੈਮ ਤੁਸੀਂ ਇੱਕ ਵਾਰ ਦੁਬਾਰਾ ਦੱਸ ਸਕਦੇ ਕਿਉਂਕਿ ਡਿਟੇਲ ਕੀ ਸੀਗੀ ਗੱਡੀ ਦੀ ਕੀ ਆਪਾਂ ਪਤਾ ਕਰ ਸਕੀਏ ਕਿ ਗੱਡੀ ਕਿਹੜੀ ਹ ਤੇ ਮੈਮ ਤੁਸੀਂ ਸਾਨੂੰ ਦੱਸ ਆਪਣਾ ਨੰਬਰ ਦਾ ਦੱਸ ਸਕਦੇ ਹੋ ਕੁਝ ਕਿ ਜਿੰਵੇਂ ਕਰਕੇ ਤੁਹਾਨੂੰ ਆਪਾਂ ਕੁਝ ਪੁਰਸਕਾਰ ਦੇ ਸਕੀਏ ਕਿ ਤੁਸੀਂ ਟਰੈਫਿਕ ਦੇ ਨਿਯਮਾਂ ਦਾ ਪਾਲਣ ਕਰਦੇ ਹੈਗੇ ਤੇ ਜਰੂਰੀ ਸਮਝਿਆ ਕੀ ਆਪਾਂ ਟ੍ਰੈਫਿਕ ਪੁਲਿਸ ਦੱਸ ਸਕੀਏ ਕੀ ਇਦਾਂ ਤਾਂ ਹੋ ਰਿਹਾ ਰੈਸ਼ ਡਰਾਈਵਿੰਗ ਕਰਦੇ ਨੇ ਕੁਝ ਲੋਕ ਗਲਤ ਤਰੀਕਾ ਚਲਾ ਰਹੇ ਨੇ ਤੇ ਇਹਨਾਂ ਦੁਰਘਟਨਾ ਹੋ ਸਕੇ ਇਸ ਕਰਕੇ ਅਸੀਂ ਤੁਹਾਨੂੰ ਸਨਮਾਨਿਤ ਕਰਨਾ ਚਾਹੁੰਦੇ ਆ ਕਿ ਆਪਣੀ ਡਿਟੇਲ ਦੇ ਸਕਦੇ ਹੋ ਸਾਨੂੰ ਨੀ ਮੈਮ ਸ਼ਾਹ ਜਰੂਰੀ ਹ ਸਾਨੂੰ ਉਤੋਂ ਦੀ ਓਡਰ ਆਏ ਹੈਗੇ ਕਿ ਜੋ ਵੀ ਸਾਨੂੰ ਕੋਈ ਰਿਪੋਰਟ ਕਰਦਾ ਹੈਗਾ ਕਿ ਅਸੀਂ ਆਰਡਰ ਸਨਮਾਨ ਦੀਏ ਤੇ ਉਹਨਾਂ ਨੂੰ ਕੁਝ ਪੁਰਸਕਾਰ ਦੀਏ ਜਿਹਦੇ ਕਰਕੇ ਲੋਕਾ ਵਿੱਚ ਹੋਰ ਹੋਵੇ ਕਿ ਆਪਾਂ ਰਿਪੋਰਟ ਕਰਕੇ ਹੋਈਏ ਤੇ ਉਹਨਾਂ ਕੁਝ ਹੋਵੇ ਵੀ ਸਾਨੂੰ ਵੱਧ ਤੋਂ ਵੱਧ ਰਿਪੋਰਟ ਮਿਲੇਗੀ ਆਪਾਂ ਐਕਸ਼ਨ ਲੈ ਸਕੀਏ ਬਣਦੀ ਕਾਰਵਾਈ ਕਰੀਏ ਮੈਮ ਜਿੱਦਾ ਜੀ ਤੁਹਾਡਾ ਨਾਮ ਤੁਹਾਡਾ ਫੋਨ ਨੰਬਰ ਉਮਰ ਬਸ ਐਹ ਤਿੰਨ ਚੀਜ਼ਾਂ ਚਾਹੀਦੀਆਂ ਸਾਨੂੰ ਤੇ ਆਪਾਂ ਤੁਹਾਡਾ ਅੱਗੇ ਦਾਂਗੇ ਫਿਰ ਉਹ ਆਪੇ ਕਾਰਵਾਈ ਆਪੇ ਕਰ ਲੇਗੇ ਸਾਨੂੰ ਬਸ ਇੰਨੀ ਚੀਜ਼ਾਂ ਚਾਹੀਦੀਆਂ ਓਕੇ ਮੈਮ ਆਪ ਜੀ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਰਿਪੋਰਟ ਕੀਤੀ ਤੇ ਆਪਾਂ ਹੁਣ ਬਣਦੀ ਕਾਰਵਾਈ ਕਰਾਂਗੇ ਤੇ ਇਸ ਦੇ ਮੁਕਾਬਲੇ ਤੁਹਾਨੂੰ ਨੋਟਿਸ ਐਸ ਐਮ ਐਸ ਆ ਜਾਏਗਾ ਜਿਹਦੇ ਚ ਤੁਹਾਨੂੰ ਪਤਾ ਚਲ ਜਾਏਗੀ ਤੁਹਾਡੀ ਕਾਰਵਾਈ ਪੂਰੀ ਹੋ ਚੁੱਕੀ ਹੈਗੀ ਤੇ ਵੋਟ ਦਾ ਥਾਨੂੰ ਇੱਕ ਦੇ ਦਾਂਗੇ ਤੁਹਾਨੂੰ ਓਕੇ ਮੈਮ ਓਕੇ ਮੈਮ